ਤਿੰਨ ਜਨਵਰੀ ਦੋ ਹਜ਼ਾਰ ਤੇਰਾਂ ਚਾਰ ਮਈ ਦੋ ਹਜ਼ਾਰ ਚੋਦ੍ਹਾਂ ਸੱਤ ਜੁਲਾਈ ਦੋ ਹਜ਼ਾਰ ਪੰਦਰ੍ਹਾਂ ਅੱਠ ਜੂਨ ਦੋ ਹਜ਼ਾਰ ਸਤਾਰਾਂ ਦਸ ਅਗਸਤ ਦੋ ਹਜ਼ਾਰ ਉੱਨੀ